ਭਾਰਤ ਇੱਕ ਰਾਜਨੀਤੀ ਦੇਸ਼ ਹੈ ਇੱਥੇ ਵੱਖਰੇ ਵੱਖਰੇ ਰਾਜਨੀਤੀ ਪਾਰਟੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ ਜਿਵੇਂ ਕਾਂਗਰਸ ਹੋ ਗਈ ਹੈ ਬੀ ਜੇ ਪੀ ਹੋ ਗਈ ਆਪ ਹੋ ਗਈ ਪਰ ਹਰ ਪਾਰਟੀ ਜੋ ਹੈ ਉਹ ਆਪਣੇ ਬਾਰੇ ਜ਼ਿਆਦਾ ਸੋਚਦੀ ਹੈ ਮੇਰੇ ਹਿਸਾਬ ਨਾਲ ਜਦੋਂ ਉਹ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਉਹ ਪਿੱਛੇ ਪਿੱਛੇ ਆ ਕੇ ਕਹਿੰਦੇ ਅਸੀਂ ਤੁਹਾਡੇ ਲਈ ਇਹ ਕਰਾਂਗੇ ਉਹ ਕਰਾਂਗੇ ਪਰ ਜਦੋਂ ਉਹਨਾਂ ਦੇ ਹੱਥ 'ਚ ਕੁਰਸੀ ਆ ਜਾਂਦੀ ਉਸ ਤੋਂ ਬਾਅਦ ਉਹ ਕੋਈ ਵੀ ਕੰਮ ਲੋਕਾਂ ਦੇ ਲਈ ਮਤਲਬ ਬਹੁਤ ਘੱਟ ਕਰਦੇ ਨੇ ਦਸ ਪਰਸੈਂਟ ਕਰਨਗੇ ਨੱਬੇ ਪਰਸੈਂਟ ਉਹ ਆਪਣੇ ਲਈ ਕਰਨਗੇ ਅਤੇ ਜਿੱਥੋਂ ਤੱਕ ਇਹ ਭਾਰਤ ਇੱਕ ਲੋਕ ਲੋਕਤੰਤਰ ਰਾਜ ਹੈ ਹਾਂ ਭਾਰਤ ਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਜਿਵੇਂ ਕੋਈ ਵੀ ਕੰਮ ਕਰ ਸਕਦੇ ਹਾਂ ਕੋਈ ਵੀ ਚੀਜ਼ ਪਹਿਨ ਸਕਦੇ ਹਾਂ ਘੁੰਮ ਫਿਰ ਸਕਦੇ ਹਾਂ ਇਸ ਲਈ ਸਾਨੂੰ ਕੋਈ ਰੋਕ ਟੋਕ ਨਹੀਂ ਹੈ ਅਤੇ ਭਾਰਤ ਸਮੇਂ ਰਾਜ ਉਹ ਰਾਜਨੀਤੀ ਵਿੱਚ ਜੋ ਨੇਤਾ ਹੈ ਉਹ ਅਤੇ ਕੋਈ ਖਾਸ ਨਹੀਂ ਹੈਗਾ ਹਾਂ ਜੋ ਸਾਡੇ ਬਾਰੇ ਸੋਚੇਗਾ ਅੱਗੇ ਅਤੇ ਉਹ ਮੈਨੂੰ ਲੱਗੇਗਾ ਕਿ ਮੇਰੇ ਲਈ ਵਧੀਆ ਹੋਏਗਾ ਜੋ ਦੇਸ਼ ਦੇ ਬਾਰੇ ਸੋਚੇਗਾ ਬਾਕੀ ਇਹ ਕਿ ਜਿਹੜੀ ਵੀ ਪਾਰਟੀ ਹੁੰਦੀ ਹੈ ਉਹ ਥੋੜ੍ਹੀ ਦੇਰ ਲਈ ਕੰਮ ਜ਼ਰੂਰ ਕਰਦੀ ਹੈ ਪਰ ਉਸ ਤੋਂ ਬਾਅਦ ਉਹ ਆਪਣੇ ਬਾਰੇ ਹੀ ਸੋਚਣ ਲੱਗਦੀ ਹੈ ਅਤੇ